ਪੰਜ ਜੂਨ ਦੋ ਹਜ਼ਾਰ ਇੱਕ ਸੱਤ ਫਰਵਰੀ ਦੋ ਹਜ਼ਾਰ ਪੰਜ ਬਾਰਾਂ ਅਪ੍ਰੈਲ ਦੋ ਹਜ਼ਾਰ ਬਾਰਾਂ ਚੌਦਾਂ ਅਕਤੂਬਰ ਦੋ ਹਜ਼ਾਰ ਵੀਹ ਅਠਾਈ ਨਵੰਬਰ ਦੋ ਹਜ਼ਾਰ ਤੇਈ